ਹੈਲੋ ਹਾਂਜੀ ਮੈਂ ਇੱਕ ਕਿਤਾਬ ਨੂੰ ਪੜ੍ਹਨ ਵਿੱਚ ਆਮ ਤੌਰ 'ਤੇ ਇੱਕ ਘੰਟਾ ਜਾਂ ਅੱਧਾ ਇੱਕ ਘੰਟਾ ਜਾਂ ਉਸ ਤੋਂ ਵੱਧ ਦਾ ਸਮਾਂ ਲੈਂਦਾ ਹਾਂ ਇਸ ਕਿਤਾਬ ਨੂੰ ਪੜ੍ਹ ਮੈਂ ਸਿੱਧਾ ਵੀ ਪੜ੍ਹ ਸਕਣ ਲੈਂਦਾ ਹਾਂ ਕਈ ਵਾਰ ਬ ਮੈਂ ਬੈਠ ਕੇ ਵੀ ਪੜ੍ਹ ਲੈਂਦਾ ਜਾਂ ਕਈ ਵਾਰੀ ਮੈਂ ਉਸ ਨੂੰ ਲੇਟ ਕੇ ਵੀ ਪੜ੍ਹ ਸਕਦਾ ਹਾਂ ਇਸ ਪ ਕਿਤਾਬ ਨੂੰ ਪੜ੍ਹਨ ਲਈ ਮੇਰੇ ਕੋਲ ਕੋਈ ਮਾਸਿਕ ਹਫਤਾਵਾਰੀ ਟੀਚੇ ਹਨ ਨਹੀਂ ਹਨ ਮੈਂ ਇਸ ਨੂੰ ਪਰਵਾਹ ਨਾਲ ਜਾਂਦੇ ਹਾਂ ਮੈਂ ਜ਼ਿਆਦਾਤਰ ਇਸ ਕਿਤਾਬਾਂ ਵਿੱਚੋਂ ਧਾਰਮਿਕ ਕਿਤਾਬਾਂ ਹੀ ਪੜ੍ਹਦਾ ਹਾਂ ਜਿਵੇਂ ਹਨੂੰਮਾਨ ਚਾਲੀਸਾ ਗੁਰੂ ਗ੍ਰੰਥ ਸਾਹਿਬ ਜਾਂ ਗੀਤਾ ਇਹਨਾਂ ਦਾ ਇਹ ਹੀ ਉਪਦੇਸ਼ ਪੜ੍ਹਦਾ ਹਾਂ ਕਿਉਂਕਿ ਇਹਨਾਂ ਕਿਤਾਬਾਂ ਨੂੰ ਪੜ੍ਹਨ ਨਾਲ ਮੈਨੂੰ ਕੁਛ ਸਿੱਖਣ ਨੂੰ ਮਿਲਦਾ ਹੈ ਮੈਨੂੰ ਇੱਕ ਸੱਚੇ ਰਾਹ ਉੱਤੇ ਚੱਲਣ ਦਾ ਉਪਦੇਸ਼ ਮਿਲਦਾ ਹੈ ਇਨ੍ਹਾਂ ਇਨ੍ਹਾਂ ਕਿਤਾਬਾਂ ਤੋਂ ਇਲਾਵਾ ਮੈਂ ਕੁਛ ਜਰਨਲ ਨੌਲੇਜ ਦੀਆਂ ਕਿਤਾਬਾਂ ਵੀ ਪੜ੍ਹਦਾ ਰਹਿੰਦਾ ਹਾਂ ਜਿਨ੍ਹਾਂ ਵਿੱਚੋਂ ਵਿੱਚੋਂ ਮੈਨੂੰ ਦੁਨੀਆ ਵਿੱਚ ਕੀ ਕੁਝ ਚੱਲ ਰਿਹਾ ਹੈ ਅੱਜ ਦੇ ਸਮੇਂ ਵਿੱਚ ਉਹ ਸਾਰਾ ਕੁਝ ਸਿੱਖਣ ਨੂੰ ਮਿਲਦਾ ਹੈ ਇਨ੍ਹਾਂ ਕਿਤਾਬਾਂ ਦੇ ਨਾਲ ਨਾਲ ਮੈਂ ਅੱਜ ਦੇ ਯੁੱਗ ਦੇ ਅਖਬਾਰ ਵੀ ਪੜ੍ਹ ਲੈਂਦਾ ਹਾਂ ਜੋ ਕਿ ਮੈਨੂੰ ਬਹੁਤ ਕੁਛ ਸਿਖਾਉਂਦੇ ਹਨ ਅਤੇ ਇਨ੍ਹਾਂ ਨਾਲ ਹੀ ਮੇਰਾ ਗਿਆਨ ਵੱਧਦਾ ਹੈ